ਹੈਲੋ ਨਮਸਕਾਰ ਸਰ ਸ਼ਾਮ ਢਾਬੇ ਤੋਂ ਬੋਲਦੇ ਜੀ ਠੀਕ ਆ ਜੀ ਮੈਂ ਬਠਿੰਡੇ ਤੋਂ ਜਨਤਾ ਨਗਰ ਤੋਂ ਬੋਲਦਾ ਸਰ ਥੋੜ੍ਹੀ ਇੱਕ ਸ਼ਿਕਾਇਤ ਸੀ ਤੁਹਾਡੇ ਨਾਲ ਇੱਕ ਉਲਾਂਭਾ ਜਿਹਾ ਵੀ ਦੇਣਾ ਸੀਗਾ ਸਰ ਹਾਂਜੀ ਐਕਚੁਲੀ ਮੈਂ ਪਰਸੋਂ ਆਰਡਰ ਕੀਤਾ ਸੀਗਾ ਚਾਰ ਪੰਜ ਡੋਸਾ ਅਤੇ ਛੇ ਬਰਗਰ ਐਂਡ ਚੌਮੀਨ ਅਤੇ ਉੱਦੋਂ ਜੀ ਜੀ ਜੀ ਜੀ ਜੀ ਬਿਲਕੁਲ ਬਿਲਕੁਲ ਹਾਂ ਹਾਂ ਸਮਾਨ ਆ ਗਿਆ ਸੀਗਾ ਬਟ ਇੱਕ ਸ਼ਿਕਾਇਤ ਇਹ ਹੈ ਕਿ ਤੁਸੀਂ ਜਿਹੜੀ ਪੈਕਜਿੰਗ ਕੀਤੀ ਹੈ ਨਾ ਇਹ ਇਸ ਵਾਰ ਬੜੀ ਪੂਅਰ ਲੈਵਲ ਦੀ ਹੋ ਗਈ ਹਾਂਜੀ ਹਾਂਜੀ ਹਾਂਜੀ ਪੂਅਰ ਲੈਵਲ ਦੀ ਇੰਨ ਦੀ ਸੈਂਸ ਕਿ ਜਦੋਂ ਮੈਂ ਬਰਗਰਾਂ ਵਾਲਾ ਪੈਕਟ ਖੋਲਿਆ ਅਤੇ ਪੈਕਟ ਕਾਹਦਾ ਸੀ ਬਸ ਊਂਈਂ ਲਪੇਟਿਆ ਜਿਹਾ ਹੋਇਆ ਸੀ ਠੀਕ ਹੈ ਔਰ ਅਗਰ ਤੁਸੀਂ ਚੋਮੀਂਨ ਨੂੰ ਜੋ ਨੁੱਡਲ ਸੀ ਉਹਨੂੰ ਉਹਨੂੰ ਵੀ ਚੰਗੀ ਤਰ੍ਹਾਂ ਤੁਸੀਂ ਪੈਕੇਜਿੰਗ ਕਰ ਦਿੰਦੇ ਨਾ ਉਹ ਠੰਡੀਆਂ ਨਾ ਹੁੰਦੀਆਂ ਜੀ ਔਰ ਡੋਸਾ ਤੁਸੀਂ ਜਾਣਦੇ ਹੋ ਠੀਕ ਹੈ ਕਿੰਨੀ ਸੈਂਸਟਿਵ ਜਿਹੀ ਚੀਜ਼ ਆ ਉਹ ਤਾਂ ਮਤਲਬ ਮੈਂ ਹੈਰਾਨ ਸੀ ਦੇਖ ਕਰਕੇ ਕਿ ਉਹਨੂੰ ਇੰਨਾ ਟਾਈਟਲ ਪੈਕਜ ਕੀਤਾ ਜੀ ਜੀ ਜੀ ਅਤੇ ਪੈਕਜਿੰਗ ਇਹਨੂੰ ਤੁਸੀਂ ਨਾ ਥੋੜ੍ਹਾ ਜਿਹਾ ਸੁਧਾਰ ਲੈਂਦੇ ਤਾਂ ਮੈਨੂੰ ਥੋੜ੍ਹਾ ਜਿਹਾ ਹਾਂ ਆਪਣੀ ਗੈਸਟ ਜਿਹੜੇ ਆਏ ਸੀ ਨਾ ਉਹ ਖੁਸ਼ ਨਹੀਂ ਹੋਏ ਅੱਛਾ ਉਹ ਖੁਸ਼ ਨਹੀਂ ਹੋਏ ਤਾਂ ਇੱਕ ਕਲੀਅਰ ਜਿਹੀ ਗੱਲ ਹੈ ਕਿ ਫਿਰ ਮੇਰਾ ਵੀ ਮਨ ਪ੍ਰਸੰਨ ਨਹੀਂ ਹੋਇਆ ਹਾਂਜੀ ਹਾਂਜੀ ਹਾਂਜੀ ਅਤੇ ਬਸ ਬੇਨਤੀ ਹੈ ਤੁਹਾਡੀ ਸਰਵਿਸ ਬਹੁਤ ਚੰਗੀ ਰਹੀ ਹੈ ਪਹਿਲਾਂ ਵੀ ਅਤੇ ਮੈਂ ਉਮੀਦ ਕਰਦਾ ਜੀ ਜੀ ਜੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਤੁਹਾਡਾ ਪੱਕਾ ਗ੍ਰਾਹਕ ਹਾਂ ਅਤੇ ਮੈਂ ਬਸ ਉਮੀਦ ਕਰਦਾ ਕਿ ਅੱਗੇ ਤੋਂ ਤੁਸੀਂ ਆਪਣੇ ਗ੍ਰਾਹਕਾਂ ਦਾ ਕਿਉਂਕਿ ਰੱਬ ਵਰਗੇ ਹੁੰਦੇ ਗ੍ਰਾਹਕ ਹਾਂਜੀ ਹਾਂਜੀ ਅਤੇ ਤੁਸੀਂ ਧਿਆਨ ਰੱਖੋਗੇ ਬਸ ਇਹ ਹੀ ਬੇਨਤੀ ਸੀ ਜੀ ਠੀਕ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ